ਸਤਿ ਸ਼੍ਰੀ ਅਕਾਲ ਮੇਰਾ ਨਾਂ ਅਰਮਾਨਦੀਪ ਸਿੰਘ ਹੈ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰੇ ਅਨੁਭਵ ਨਾਲ ਭੰਗੜਾ ਬਹੁਤ ਵਧੀਆ ਅਤੇ ਬਹੁਤ ਹੀ ਵਧੀਆ ਖੇਡ ਹੈ ਜਿਸ ਨੂੰ ਖੇਡਣ ਨਾਲ ਸਾਡੇ ਮਨ ਨੂੰ ਤੰਦਰੁਸਤੀ ਅਤੇ ਮਨ ਨੂੰ ਬਹੁਤ ਵਧੀਆ ਅਤੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਭੰਗੜਾ ਮੇਰੇ ਹਿਸਾਬ ਨਾਲ ਤਾਂ ਰੈਬਿਕ ਭਵਿੱਖ ਵਿੱਚ ਅਰਾਬਿਕ ਦੀ ਪ੍ਰਸਿੱਧ ਪ੍ਰਸਿੱਧ ਹੋਵੇਗਾ ਕਿਉਂਕਿ ਭੰਗੜਾ ਅੱਜ ਕੱਲ੍ਹ ਪੰਜਾਬ ਵਿੱਚ ਭੰਗੜਾ ਅਤੇ ਹੋਰ ਦੇਸ਼ਾਂ ਵਿੱਚ ਭੰਗੜੇ ਨੂੰ ਬਹੁਤ ਉੱਚੇ ਸਥਾਨ 'ਤੇ ਰੱਖਿਆ ਗਿਆ ਹੈ ਭੰਗੜੇ ਪਾਉਣ ਵਾਲੇ ਖਿਡਾਰੀਆਂ ਨੂੰ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਹੋਰ ਬਾਹਰਲੀਆਂ ਕੰਟਰੀਆਂ ਵੀ ਭੰਗੜੇ ਨੂੰ ਬਹੁਤ ਵਧੀਆ ਹਿਸਾਬ ਨਾਲ ਮੰਨਦੇ ਹਨ ਭੰਗੜਾ ਬਹੁਤ ਹੀ ਵਧੀਆ ਅਤੇ ਭੰਗੜਾ ਕਰਨ ਵਾਲੇ ਬੱਚੇ ਬਹੁਤ ਹੀ ਤੰਦਰੁਸਤ ਅਤੇ ਮਾਣ ਮਹਿਸੂਸ ਕਰਦੇ ਹਨ ਨਾਲ ਆਪਣੇ ਪਰਿਵਾਰ ਦਾ ਅਤੇ ਆਪਣੇ ਪਿੰਡ ਜ਼ਿਲ੍ਹੇ ਹੋਰ ਵੀ ਕਈਆਂ ਦਾ ਨਾਮ ਰੋਸ਼ਨ ਕਰਦੇ ਹਨ ਸਭ ਤੋਂ ਭੰਗੜਾ ਕਰਵਾਉਣ ਵਿੱਚ ਸਭ ਤੋਂ ਮੇਨ ਰੋਲ ਹੁੰਦਾ ਹੈ ਉਹ ਭੰਗੜੇ ਕੋਚ ਦਾ ਜਿਹੜਾ ਕਿ ਆਪਣੇ ਭੰਗੜੇ ਨੂੰ ਭਵਿੱਖ ਅਰੈਬਿਕ ਭੀ ਅਰਾਬਿਕ ਤੱਕ ਪ੍ਰਸਿੱਧ ਕਰ ਗਿਆ ਹੈ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵੀ ਕਈਆਂ ਦੇਸ਼ਾਂ ਵਿੱਚ ਵੀ ਭੰਗੜਾ ਪਾਇਆ ਜਾਵੇਗਾ ਆਪਣੇ ਪੰਜਾਬ ਨੂੰ ਪੰਜਾਬ ਵਿੱਚ ਤਾਂ ਚੱਲੋ ਕਰਦੇ ਕਰਦੇ ਹਨ ਹੋਰ ਵੀ ਕਈ ਕੰਟਰੀਆਂ ਵਿੱਚ ਜਿੱਥੇ ਨਹੀਂ ਭੰਗੜਾ ਹੁੰਦਾ ਆਉਣ ਵਾਲੇ ਸਮੇਂ ਵਿੱਚ ਉੱਥੇ ਵੀ ਭੰਗੜੇ ਪਾਇਆ ਕੀਤਾ ਜਾਵੇਗਾ ਭੰਗੜਾ ਪਾਉਣ ਨਾਲ ਭੰਗੜੇ ਭ ਭੰਗੜਾ ਬਹੁਤ ਹੀ ਵਧੀਆ ਅਤੇ ਬਹੁਤ ਸਹੀ ਲੱਗ ਬਹੁ ਸ ਬਹੁਤ ਹੀ ਘੈਂਟ ਬਹੁਤ ਸਹੀ ਹੈ ਭੰਗੜੇ ਨਾ ਕਰਨ ਨਾਲ ਬਹੁਤ ਮਾਣ ਮਹਿਸੂਸ ਹੁੰਦਾ ਹੈ ਪਰਿਵਾਰ ਦਾ ਨਾਮ ਵੀ ਰੋਸ਼ਨ ਹੁੰਦਾ ਹੈ ਮੇਰੇ ਆਪਣੇ ਕਈ ਯਾਰ ਵੇਲੀ ਭੰਗੜੇ ਦੇ ਹ ਭੰਗੜੇ ਦੀ ਟੀਮ ਵਿੱਚ ਹਨ